ਜਦੋਂ ਖੇਡਣ ਲਈ ਕਿਸੇ ਵੀ ਕਿਸਮ ਦੀ ਖੇਡ ਨੂੰ ਚੁਣਨ ਦੀ ਗੱਲ ਆਉਂਦੀ ਹੈ ਤਾਂ ਇਹ ਨਿਰਭਰ ਕਰਦਾ ਹੈ ਕਿ ਤੁਸੀਂ ਉਸ ਗੇਮ ਵਿੱਚ ਕਿੰਨੀ ਰੁਚੀ ਲੈਂਦੇ ਹੋ ਅਤੇ ਤੁਹਾਨੂੰ ਉਹ ਖੇਡ ਖੇਡ ਕੇ ਖੁਸ਼ੀ ਹੁੰਦੀ ਹੈ ਕਿ ਨਹੀਂ ਗੇਮਾਂ ਕਈ ਕਿਸਮ ਦੀਆਂ ਹੁੰਦੀਆਂ ਹਨ ਜਿਵੇਂ ਆਰ ਪੀ ਜੀ ਰੋਲ ਪਲੇਇੰਗ ਗੇਮ ਨੀਤੀ ਖੇਡਾਂ ਐਫ ਪੀ ਐਸ ਫਸਟ ਪਰਸਨ ਸ਼ੂਟਰ ਗੇਮ ਅਤੇ ਹੋਰ ਤਰ੍ਹਾਂ ਦੀਆਂ ਗੇਮਾਂ ਹੁੰਦੀਆਂ ਹਨ ਤੁਸੀਂ ਕਿਸ ਕਿਸਮ ਦੀ ਖੇਡ ਖੇਡਣਾ ਚਾਹੁੰਦੇ ਹੋ ਇਹ ਨਿਰਭਰ ਕਰਦਾ ਹੈ ਕਿ ਤੁਸੀਂ ਉਹ ਖੇਡ ਖੇਡ ਕੇ ਕਿਸ ਤਰ੍ਹਾਂ ਦਾ ਅਨੁਭਵ ਕਰ ਰਹੇ ਹੋ ਜਿਵੇਂ ਤੁਸੀਂ ਕਹਾਣੀਆਂ 'ਚ ਗੁੰਝਲਦਾਰ ਕਿਰਦਾਰਾਂ ਨੂੰ ਜਾਣਨਾ ਪਸੰਦ ਕਰਦੇ ਹੋ ਤਾਂ ਤੁਹਾਡੇ ਲਈ ਆਰ ਪੀ ਜੀ ਰੋਲ ਪਲੇਇੰਗ ਗੇਮ ਬਿਲਕੁਲ ਸਹੀ ਹੈ ਜੇ ਤੁਹਾਨੂੰ ਤੇਜ਼ ਰਫਤਾਰ ਵਿੱਚ ਕਾਰਵਾਈ ਅਤੇ ਰਣਨੀਤੀ ਦੀ ਤਲਾਸ਼ ਰਹਿੰਦੀ ਹੈ ਤਾਂ ਤੁਹਾਡੇ ਲਈ ਐਫ ਪੀ ਐਸ ਖੇਡ ਫਸਟ ਪਰਸਨ ਸ਼ੂਟਰ ਖੇਡਾਂ ਬਿਲਕੁਲ ਸਹੀ ਹਨ ਤੁਸੀਂ ਯੋਜਨਾ ਬਣਾ ਕੇ ਅਤੇ ਕਿਸੇ ਵੀ ਚੁਣੌਤੀ ਦਾ ਹੱਲ ਖੋਜਣਾ ਪਸੰਦ ਕਰਦੇ ਹੋ ਤਾਂ ਤੁਹਾਡੇ ਲਈ ਰਣਨੀਤੀ ਖੇਡਾ ਬਿਲਕੁਲ ਸਹੀ ਹਨ ਜੇਕਰ ਤੁਸੀਂ ਰਹੱਸਮਈ ਦੁਨੀਆ ਵਿੱਚ ਖੋਜ ਕਰਨਾ ਪਸੰਦ ਕਰਦੇ ਹੋ ਤਾਂ ਤੁਹਾਡੇ ਲਈ ਐਡਵੈਂਚਰ ਗੇਮਾਂ ਬਿਲਕੁਲ ਸਹੀ ਹਨ ਜੇਕਰ ਤੁਸੀਂ ਅਸਲ ਜ਼ਿੰਦਗੀ ਦੀਆਂ ਗਤੀਵਿਧੀਆਂ ਜਿਵੇਂ ਉੱਡਣਾ ਖੇਤੀਬਾੜੀ ਕਰਨਾ ਬਿਜਨਸ ਚਲਾਉਣਾ ਦਾ ਅਨੁਭਵ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸਿਮੀਲੇਟਰ ਗੇਮਾਂ ਬਿਲਕੁਲ ਸਹੀ ਹਨ ਜੇ ਤੁਸੀਂ ਦਿਮਾਗ ਨੂੰ ਚੁਣੌਤੀ ਦੇਣਾ ਪਸੰਦ ਕਰਦੇ ਹੋ ਤਾਂ ਤੁਹਾਡੇ ਲਈ ਪਜ਼ਲ ਗੇਮਾਂ ਬਿਲਕੁਲ ਸਹੀ ਹਨ ਜਿਹੜੀ ਵੀ ਖੇਡ ਤੁਸੀਂ ਚੁਣਦੇ ਹੋ ਮਹੱਤਵਪੂਰਨ ਇਹ ਹੈ ਕਿ ਤੁਸੀਂ ਉਸ ਵਿੱਚ ਮਜ਼ਾ ਲਵੋ ਅਤੇ ਇਸ ਨਾਲ ਤੁਸੀਂ ਜੋ ਸਿਖਣਾ ਚਾਹੁੰਦੇ ਹੋ ਉਹ ਸਿੱਖੋ ਮੇਰੀ ਮਨਪਸੰਦ ਖੇਡ ਆਰ ਪੀ ਜੀ ਖੇਡਾਂ ਹਨ ਰੋਲ ਪਲੇ ਗੇਮਸ ਮੈਨੂੰ ਕਿਰਦਾਰਾਂ ਨਾਲ ਜੁੜਨਾ ਅਤੇ ਉਹਨਾਂ ਦੀ ਕਹਾਣੀਆ ਨੂੰ ਸੁਣਨਾ ਬਿਲ ਬਹੁਤ ਪਸੰਦ ਹੈ